ਹਾਂਜੀ ਸਰ ਹਾਂਜੀ ਹਾਂਜੀ ਜੀ ਦੱਸੋ ਜੀ ਕਾਹਦੇ 'ਚ ਪ੍ਰੋਬਲਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਜੀ ਮੈਂ ਉੱਪਰੋਂ ਲਿਖੇ ਵੇ ਆ ਦੱਸ ਦਿਓ ਜਦੋਂ ਵੀ ਆਪਾਂ ਨੂੰ ਗਰਾਂਟ ਦਿੰਦੇ ਹੈ ਤਾਂ ਆਪਾਂ ਪਹਿਲ ਦੇ ਅਧਾਰ 'ਤੇ ਇਹ ਹੀ ਕੰਮ ਕਰਾਉਣੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈਗਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆਪਾਂ ਇਹ ਹੀ ਪਹਿਲ ਦੇ ਅਧਾਰ 'ਤੇ ਕੰਮ ਕਰਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹੋਰ ਦੱਸੋ ਤੁਸੀਂ ਹਾਂਜੀ ਹਾਂਜੀ ਪਹਿਲ ਦੇ ਅਧਾਰ 'ਤੇ ਪਾਣੀ ਵਾਲਾ ਕੰਮ ਕਰਨਾ ਐ ਅਸੀਂ ਫਿਰ ਸੜਕਾਂ ਹਾਂਜੀ ਹਾਂਜੀ

ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਉਹ ਸਭ ਬਸ ਗਰਾਂਟ ਆਉਣ ਦਿਓ ਸਭ ਆਪਾਂ ਕੰਮ ਸਾਰੇ ਕਰਵਾ ਦੇਣੇ ਹੈ ਜੀ ਜਿੰਨੀਆਂ ਵੀ ਸਮੱਸਿਆਵਾਂ ਹੂੰ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆਪਾਂ ਪੁੱਛਦੇ ਹਾਂ ਉਹ ਕਿਉਂ ਨਹੀਂ ਕੀ ਗੱਲ ਹੈ ਕੀ ਪ੍ਰੋਬਲਮ ਆ ਉਹਨਾਂ ਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਜ਼ਰੂਰ ਕਰ ਦਿੰਦੇ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ